ਸਤਾਈ ਅੱਠ ਦੋ ਹਜ਼ਾਰ ਤਿੰਨ ਸੱਤ ਨੌ ਦੋ ਹਜ਼ਾਰ ਵੀਹ ਗਿਆਰਾਂ ਇੱਕ ਦੋ ਹਜ਼ਾਰ ਸੱਤ ਸੋਲਾਂ ਇੱਕ ਉੱਨੀ ਸੌ ਬਿਆਸੀ ਉਨੱਤੀ ਛੇ ਦੋ ਹਜ਼ਾਰ ਸੋਲਾਂ